ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਤੁਸੀਂ ਕਿੱਥੋਂ ਓਕੇ ਜੀ ਓਕੇ ਓਕੇ ਜੀ ਤੁਹਾਨੂੰ ਮਤਲਬ ਸਾਡੇ ਇੰਸਟੀਟਿਊਟ ਦਾ ਰੈਫਰੈਂਸ ਕਿਸ ਨੇ ਦਿੱਤਾ ਮਤਲਬ ਤੁਹਾਨੂੰ ਕਿੱਥੋਂ ਪਤਾ ਲੱਗਿਆ ਓਕੇ ਜੀ ਓਕੇ ਜੀ ਮੈਮ ਅਸੀਂ ਅਸੀਂ ਨਾ ਐਕਚੁਲੀ ਮਤਲਬ ਸਾਡਾ ਜੋ ਆਇਲੈਟਸ ਦਾ ਕੋਰਸ ਆ ਉਹ ਤਿੰਨ ਮਹੀਨੇ ਦਾ ਹੈ ਤਾਂ ਉਹਦੇ ਵਿੱਚ ਤੁਹਾਨੂੰ ਸਪੀ ਜਿੱਦਾਂ ਮਤਲਬ ਆਪਣੀ ਹੈ ਲਿਸਨਿੰਗ ਰਾਈਟਿੰਗ ਸਪੀਕਿੰਗ ਰੀਡਿੰਗ ਚਾਰੇ ਮੋਡਊਲਸ ਨੇ ਜਿਹੜਾ ਉਹਨਾਂ ਦੀ ਪੂਰੇ ਵਧੀਆ ਤਰੀਕੇ ਨਾਲ ਤਿਆਰੀ ਕਰਵਾਈ ਜਾਂਦੀ ਹੈ ਅਤੇ ਉਹਦੇ ਲਈ ਤੁਹਾਨੂੰ ਵੱਖਰੇ ਵੱਖਰੇ ਟਾਸਕ ਆ ਜਿਹੜੇ ਉਹ ਦਿੱਤੇ ਜਾਂਦੇ ਨੇ ਮਤਲਬ ਤੁਸੀਂ ਇਹ ਸਿਰਫ਼ ਇਹ ਨਹੀਂ ਵੀ ਤੁਸੀਂ ਸਿਰਫ਼ ਆਪਣੀ ਕਲਾਸ ਵਿੱਚ ਜੋ ਤੁਹਾਨੂੰ ਕਰਵਾਉਂਦੇ ਸੀ ਉਹ ਹੀ ਵਰਕ ਕਰਨਾ ਤੁਹਾਨੂੰ ਉਹ ਤੋਂ ਐਕਸਟਰਾ ਵਰਕ ਵੀ ਦਿੱਤਾ ਜਾਂਦਾ ਉਹਦੇ ਨਾਲ ਮਿਲਦਾ ਜੁਲਦਾ ਤਾਂ ਕਿ ਤੁਹਾਡੀ ਜਿਹੜੀ ਆ ਮਤਲਬ ਕਾਫ਼ੀ ਵਧੀਆ ਇੰਪਰੂਵਮੈਂਟ ਹੋਵੇ ਤੁਹਾਨੂੰ ਕਿਯੂ ਕਾਰਡ ਵੀ ਆ ਜੋ ਨਵੇਂ ਪ੍ਰੋਵਾਈਡ ਕੀਤੇ ਜਾਂਦੇ ਆ ਤਾਂ ਹਾਂ ਮਤਲਬ ਹੈ ਕਿ ਮਤਲਬ ਤੁਹਾਡੀ ਕਾਫ਼ੀ ਜ਼ਿਆਦਾ ਇੰਪਰੂਵਮੈਂਟ ਹੋ ਜਾਣੀ ਅਗਰ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਅਗਰ ਜੇ ਆਪਾਂ ਗੱਲ ਕਰੀਏ ਫੀਸ ਵਗੈਰਾ ਦੀ ਤਾਂ ਫੀਸ ਮਤਲਬ ਇਥੇ ਹੈ ਕਿ ਪਰ ਮੰਥ ਪੰਦਰਾਂ ਹਜ਼ਾਰ ਰੁਪਏ ਫੀਸ ਇਹਨਾਂ ਦੀ ਜੋ ਹੈਗੀ ਆ ਅਤੇ ਅਗਰ ਬੱਚੇ ਦੀ ਜੋ ਸਪੀਕਿੰਗ ਹੈ ਉਹ ਬਹੁਤ ਜ਼ਿਆਦਾ ਵੀਕ ਹੈ ਤਾਂ ਅਸੀਂ ਉਹਦੇ ਤੋਂ ਇਲਾਵਾ ਮਤਲਬ ਕਿ ਤੁਹਾਨੂੰ ਤਿੰਨ ਮਹੀਨੇ ਦੇ ਕੋਰਸ ਤੋਂ ਇਲਾਵਾ ਜੋ ਹੈ ਦੋ ਮਹੀਨੇ ਦਾ ਇੱਕ ਵੱਖਰਾ ਸਪੀਕਿੰਗ ਕੋਰਸ ਦਿੱਤਾ ਜਾਂਦਾ ਉਹਦੇ ਵਿੱਚ ਤੁਹਾਨੂੰ ਸਪੀਕਿੰਗ ਦਾ ਪੂਰਾ ਵਧੀਆ ਤਰੀਕੇ ਨਾਲ ਸਿਖਾਇਆ ਜਾਂਦਾ ਤਾਂ ਉਹ ਵੀ ਤੁਸੀਂ ਹੈ ਜੋ ਮਤਲਬ ਲੈ ਸਕਦੇ ਹੋ ਹਾਂਜੀ ਮਤਲਬ ਅਸੀਂ ਦੋ ਮਹੀਨੇ ਦਾ ਕੋਰਸ ਦਿੰਦੇ ਹਾਂ ਤਾਂ ਤੁਸੀਂ ਉਹਦੇ ਵਿੱਚ ਕਰ ਸਕਦੇ ਹੋ ਆਪਣਾ ਅਤੇ ਜਦੋਂ ਬੱਚਾ ਦੀ ਪੂਰੀ ਵਧੀਆ ਸਪੀਕਿੰਗ ਹੋ ਜਾਂਦੀ ਤਾ ਉਸ ਤੋਂ ਬਾਅਦ ਹੀ ਅਸੀਂ ਉਹਨਾਂ ਨੂੰ ਜਿਹੜਾ ਮਤਲਬ ਹੈ ਅੱਗੇ ਆਈਲੈਟਸ ਦਾ ਕੋਰਸ ਲਈ ਹੈ ਜਿਹੜਾ ਮਤਲਵ ਅੱਗੇ ਅਲਾਓ ਕਰਦੇ ਹਾਂ ਤੁਸੀਂ ਅਗਰ ਇਕੱਠੀ ਭਰਨਾ ਚਾਹੁੰਦੇ ਹੋ ਤਾਂ ਇਕੱਠੀ ਵੀ ਤੁਸੀਂ ਦੇ ਸਕਦੇ ਹੋ ਅਦਰਵਾਈਜ਼ ਤਾਂ ਤੁਸੀਂ ਪਰ ਮੰਥ ਕਰਕੇ ਮਤਲਬ ਕਿਸ਼ਤ ਬਾਏ ਕਿਸ਼ਤ ਤੁਸੀ ਦੇ ਸਕਦੇ ਹੋ ਆਪਣੀ ਫੀਸ ਜਿਹੜੀ ਹੈਗੀ ਆ ਮਤਲਬ ਜਿੱਦਾਂ ਤੁਸੀਂ ਇੱਕ ਮੰਥ ਦੀ ਦੇ ਦਿੱਤੀ ਫਿਰ ਤੁਸੀਂ ਨੈਕਸਟ ਮੰਥ ਦੇ ਦਿੱਤੀ ਇੱਦਾਂ ਤੁਸੀਂ ਦੇ ਸਕਦੇ ਹੋ ਫੀਸ ਤਾਂ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਆ ਕਲਾਸ ਦਾ ਟਾਈਮ ਹੋਊਗਾ ਸਵੇਰੇ ਨੌਂ ਤੋਂ ਸ਼ਾਮ ਦੇ ਪੰਜ ਤੱਕ ਓਕੇ ਜੀ ਵੈਲਕਮ